ਹਸਪਤਾਲਾਂ ਦੇ ਵਿੱਚ ਜਿਹੜਾ ਵਾ ਉਹ ਮਾੜਾ ਅਨੁਭਵ ਤਾਂ ਇਹੋ ਹੀ ਹੁੰਦਾ ਵਾ ਵੀ ਜਦੋਂ ਕਿਤੇ ਪਿੰਡਾਂ ਦੇ ਵਿੱਚ ਦੂਰ ਦੁਰਾਡੇ ਥਾਵਾਂ ਦੇ ਉੱਤੇ ਜਿਹੜੇ ਉਹ ਕੋਈ ਐਕਸੀਡੈਂਟ ਵਗੈਰਾ ਹੋ ਜਾਂਦਾ ਜਾਂ ਕਿਸੇ ਨੂੰ ਕੋਈ ਅਮਰਜੈਂਸੀ ਹੁੰਦੀ ਆ ਤਾਂ ਉੱਥੇ ਸਾਧਨ ਨਹੀਂ ਪਹੁੰਚਦੇ ਜਿਵੇਂ ਐਂਬੂਲੈਂਸ ਵਗੈਰਾ ਵਾ ਉਹ ਟੈਮ ਸਿਰ ਨਹੀਂ ਪਹੁੰਚ ਜਾਂਦੀ ਦੂਰ ਜ਼ਿਆਦਾ ਟਾਇਮ ਲੱਗ ਜਾਂਦਾ ਉਹਨਾਂ ਨੂੰ ਦੂਰ ਹੋਣ ਕਰਕੇ ਦੂਜਾ ਇਹ ਹੈ ਵੀ ਪਿੰਡਾਂ ਦੇ ਵਿੱਚ ਹਸਪਤਾਲ ਘੱਟ ਹੈ ਅਤੇ ਸ਼ਹਿਰ ਦੇ ਵਿੱਚ ਜਿਹੜੇ ਹਸਪਤਾਲ ਜ਼ਿਆਦਾਤਰ ਹੁੰਦੇ ਆ ਜਿੱਥੇ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੁੰਦੀਆਂ ਵਾ ਜ਼ਿਆਦਾ ਮਰੀਜ਼ ਦਾ ਜੀਟ ਸੀਰੀਅਸ ਮਰੀਜ਼ ਹੁੰਦੇ ਜਿੱਦਾਂ ਕੋਈ ਉਹਦਾ ਟੈਮ ਨਹੀਂ ਲਾਉਂਦਾ ਵਾਰੀ ਨਹੀਂ ਆਉਂਦੀ ਅਤੇ ਕਈਆਂ ਦੀ ਡੈਥ ਹੋ ਜਾਂਦੀ ਉਹਦੇ ਵਿੱਚ ਜਿਹੜੇ ਪ੍ਰਾਈਵੇਟ ਹਸਪਤਾਲ ਆ ਉਹਨਾਂ ਦੇ ਵਿੱਚ ਜਿਹੜਾ ਉਹ ਇਲਾਜ ਬਹੁਤ ਮਹਿੰਗਾ ਹੁੰਦਾ ਕਿਉਂਕਿ ਕਈ ਵਾਰ ਜਿਹੜੇ ਸਰਕਾਰੀ ਹਸਪਤਾਲਾਂ ਦੇ ਵਿੱਚ ਹੈ ਉਹ ਮਸ਼ੀਨਾਂ ਨਹੀਂ ਵੈਲਬਿਲਡ ਹੁੰਦੀਆਂ ਅਤੇ ਉਹ ਲੋਕਾਂ ਨੂੰ ਮਜ਼ਬੂਰ ਨੇੜਾ ਉਹ ਪ੍ਰਾਈਵੇਟ ਹਸਪਤਾਲਾਂ 'ਚ ਜਾਣਾ ਪੈਂਦਾ ਜਿੱਥੇ ਬਹੁਤ ਜਿਹੜਾ ਇਲਾਜ ਹੈ ਉਹ ਮਹਿੰਗਾ ਹੁੰਦਾ ਇਸ ਕਰਕੇ ਜਿਹੜਾ ਵਾ ਚਾਹੀਦਾ ਤਾਂ ਇਹ ਆ ਵੀ ਸਰਕਾਰ ਦੇ ਹਸਪਤਾਲਾਂ ਵਿੱਚ ਸਾਰੀ ਸਹੂ ਸਹੂਲਤ ਦਿੱਤੀ ਜਾਵੇ ਅਤੇ ਲੋਕਾਂ ਦੇ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਜਿਹੜੇ ਉਹ ਵੱਡੇ ਹਸਪਤਾਲ ਉਹ ਖੁੱਲ੍ਹੇ ਹੋਣ ਜਿੱਥੇ ਹਰੇਕ ਤਰ੍ਹਾਂ ਦੀਆਂ ਮਸ਼ੀਨਾਂ ਹੋਣ ਤਾਂ ਜਿਹੜੇ ਲੋਕ ਆ ਉਹ ਉਹਨਾਂ ਨੂੰ ਜ਼ਿਆਦਾ ਦੂਰ ਨਾ ਜਾਣਾ ਪਵੇ